ਪੁਰਾਣੀ ਪੀੜ੍ਹੀ ਜੋ ਹੈ ਉਹ ਬਹੁਤ ਹੀ ਸ ਸਧਾਰਨ ਸ਼ਾਂਤ ਹੈ ਜਿਹੜੀ ਅੱਜ ਦੀ ਪੀੜ੍ਹੀ ਕਹਿ ਸਕਦੇ ਹਾਂ ਅਸੀਂ ਇਹਦੇ ਵਿੱਚ ਜਿਹੜਾ ਫ਼ਰਕ ਰੱਖਾਂਗੇ ਉਹ ਚਾਲੀ ਸਾਲ ਦਾ ਫ਼ਰਕ ਲੈ ਕੇ ਚਲਦੇ ਹਾਂ ਜਿਵੇਂ ਕਿ ਮੈਂ ਇੱਕ ਆਪਣਾ ਮੈਂ ਇੱਕ ਪਿਓ ਹਾਂ ਅਤੇ ਮੇਰਾ ਪਿਓ ਵੀ ਹੈ ਅਤੇ ਮੇਰਾ ਪੁੱਤਰ ਵੀ ਹੈ ਅਤੇ ਇਹਨਾਂ ਦੇ ਵਿੱਚ ਚਾਲੀ ਪੰਜਾਹ ਸਾਲ ਦਾ ਫ਼ਰਕ ਹੈ ਪਿਓ ਜੋ ਮੇਰਾ ਪਿਓ ਹੈ ਉਹ ਕਹਿੰਦਾ ਹੈ ਸਧਾਰਨ ਖਾਓ ਆਰਾਮ ਨਾਲ ਜ਼ਿੰਦਗੀ ਜੀਓ ਕੋਈ ਜ਼ਿਆਦਾ ਖਰਚਾ ਨਾ ਕਰੋ ਕਿਉਂਕਿ ਪੈਸਾ ਜਿਹੜਾ ਹੈ ਉਹ ਮਿਹਨਤ ਨਾਲ ਕਮਾਇਆ ਗਿਆ ਜਿਹੜੀ ਅੱਜ ਦੀ ਪੀੜ੍ਹੀ ਹੈ ਜਿਵੇਂ ਕਿ ਮੇਰਾ ਬੱਚਾ ਜਾਂ ਮੈਂ ਵੀ ਅਸੀਂ ਸੋਚਦੇ ਹਾਂ ਖਰਚਾ ਕਰ ਲੈਣਾ ਚਾਹੀਦਾ ਖਰਚੋ ਨਾਲ ਥੋੜ੍ਹੀ ਲੈ ਕੇ ਜਾਣਾ ਕੁਛ ਵੱਡੀਆਂ ਗੱਡੀਆਂ ਬਹੁਤ ਆ ਗਈਆਂ ਨੇ ਪੁਰਾਣੇ ਜ਼ਮਾਨਿਆਂ 'ਚ ਸਾਈਕਲ ਹੁੰਦਾ ਸੀ ਉਹਦੇ 'ਤੇ ਹੀ ਆਉਂਦੇ ਸੀ ਉਹਦੇ 'ਤੇ ਹੀ ਜਾਂਦੇ ਸੀ ਅੱਜ ਦੇ ਟਾਈਮ 'ਚ ਤਾਂ ਕਾਰਾਂ ਹੀ ਇੰਨੀਆਂ ਜ਼ਿਆਦਾ ਹੋ ਗਈਆਂ ਅੱਜ ਦੀ ਜਿਹੜੀ ਜਨਰੇਸ਼ਨ ਹੈ ਅੱਜ ਦਾ ਜਿਹੜਾ ਬੱਚਾ ਹੈ ਉਹ ਕਹਿੰਦਾ ਹੈ ਮੈਨੂੰ ਮਹਿੰਗੀ ਗੱਡੀ ਚਾਹੀਦੀ ਹੈ ਮਹਿੰਗਾ ਫ਼ੋਨ ਚਾਹੀਦਾ ਹੈ ਜਿਹਦੇ ਕਰਕੇ ਜਿਹੜਾ ਵਿਚਕਾਰ ਇੱਕ ਜਨਰੇਸ਼ਨ ਦਾ ਰਹਿ ਜਾਂਦਾ ਜਿਵੇਂ ਕਿ ਮੈਂ ਆਪਣੇ ਆਪ ਨੂੰ ਲਗਾ ਲਵਾਂ ਮੈਂ ਹੁਣ ਆਪਣੇ ਪਿਓ ਦੀ ਮੰਨਾ ਤਾਂ ਉਹ ਠੀਕ ਹੈ ਜੇ ਮੈਂ ਆਪਣੇ ਪੁੱਤਰ ਦੀ ਮੰਨਾ ਤਾਂ ਮੈਂ ਵਿੱਚ ਪਿੱਸਦਾ ਹਾਂ ਉਹ ਇੰਜ ਪਿਸਦਾ ਹਾਂ ਪਿਓ ਕਹਿੰਦਾ ਆਰਾਮ ਨਾਲ ਚੱਲੋ ਮੈਂ ਵੀ ਕਹਾਂਗਾ ਠੀਕ ਹੈ ਜੀ ਥੋੜ੍ਹਾ ਜਿਹਾ ਖਰਚਾ ਕਰ ਲੈਂਦੇ ਆਂ ਮੁੰਡਾ ਕਹਿੰਦਾ ਖੁੱਲ੍ਹਾ ਖਰਚਾ ਕਰੋ ਸੋ ਇਹ ਤਿੰਨ ਪੀੜ੍ਹੀਆਂ ਜਿਹੜੀਆਂ ਦਾ ਵਿੱਚ ਡਿਸਟੈਂਸ ਡਿਫਰੈਂਸ ਹੈਗਾ ਫ਼ਰਕ ਹੈਗਾ ਇਹ ਜਿਹੜਾ ਇਸ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਣੀ ਹੈ ਕਿਉਂਕਿ ਸੋਚ ਸਭ ਦੀ ਅਲੱਗ ਅਲੱਗ ਹੈ ਪੁਰਾਣੇ ਪੁਰਾਣੇ ਜ਼ਮਾਨੇ ਨਾਲ ਚੱਲਦੇ ਹੈ ਅਤੇ ਨਵੇਂ ਨਵੇਂ ਨਾਲ